ਬਜ਼ੁਰਗਾਂ ਦੀ ਦਿੱਕਤ ਬਹੁਤ ਜ਼ਿਆਦਾ ਗੰਭੀਰ ਹੁੰਦੀ ਹੈ ਜਿਵੇਂ ਜਿਵੇਂ ਉਹਨਾਂ ਦੀ ਉਮਰ ਵੱਧਦੀ ਜਾਂਦੀ ਹੈ ਉਸ ਉਸਦੇ ਹਿਸਾਬ ਨਾਲ ਹੀ ਉਹਨਾਂ ਦੀ ਜਿਹੜੀ ਬਿਮਾਰੀ ਉਹ ਵੀ ਵੱਧਦੀ ਜਾਂਦੀ ਆ ਜਿਵੇਂ ਗੱਲ ਕਰਦੇ ਹਾਂ ਆਪਾਂ ਜੋ ਬੁਢਾਪਾ ਜਦੋਂ ਬੰਦਾ ਹੋ ਜਾਂਦਾ ਬੁਢਾਪੇ ਵਿੱਚ ਆ ਜਾਂਦਾ ਹੈ ਤਾਂ ਦੈਨ ਪਰਸਨ ਜੇ ਉਹਦੀ ਨਿਗ੍ਹਾ ਘੱਟ ਜਾਂਦੀ ਹੈ ਜਿਸ ਕਰਕੇ ਨਾਂ ਕੁਛ ਅਖਬਾਰ ਨਾਂ ਕੋਈ ਬੁੱਕ ਵਗੈਰਾ ਪੜ੍ਹ ਸਕਦਾ ਹੈ ਤੇ ਇਹ ਉਹਨੂੰ ਬਹੁਤ ਦਿੱਕਤ ਦਿੰਦੀ ਹੈ ਪੜ੍ਹਨ ਦੇ ਜਾਂ ਦੇਖਣ ਦੇ ਵਿੱਚ ਕੁਛ ਵੀ ਦੇਖਣ ਦੇ ਵਿੱਚ ਕਿਉਂਕਿ ਉਸਦੀ ਨਿਗ੍ਹਾ ਘੱਟ ਜਾਂਦੀ ਹੈ ਦੂਜੀ ਗੱਲ ਵੀ ਬਜ਼ੁਰਗ ਬੰਦੇ ਤੋਂ ਤੋਰਾ ਫੇਰਾ ਨਹੀਂ ਹੁੰਦਾ ਜ਼ਿਆਦਾ ਨਾਂ ਉਹ ਭੱਜ ਸਕਦਾ ਨਾਂ ਕਿਤੇ ਜਾ ਸਕਦਾ ਜ਼ਿਆਦਾ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਕਿਉਂਕਿ ਉਹ ਜਲਦੀ ਥੱਕ ਜਾਂਦੇ ਆ ਅਤੇ ਉਹਨੂੰ ਸਾਹ ਚੜ੍ਹ ਜਾਂਦਾ ਅਤੇ ਜਿਸ ਕਰਕੇ ਬਜ਼ੁਰਗਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਤੁਰਨ ਫਿਰਨ ਉੱਠਣ ਬੈਠਣ ਦੇ ਵਿੱਚ ਅਤੇ ਨਾ ਹੀ ਬਜ਼ੁਰਗ ਬੰਦਾ ਕੋਈ ਕਸਰਤ ਵਗੈਰਾ ਕਰ ਸਕਦਾ ਕੁਛ ਵੀ ਜੇ ਸਰੀਰ ਦੇ ਵਿੱਚ ਕਿਉਂਕਿ ਕਮਜ਼ੋਰੀ ਬਹੁਤ ਆ ਜਾਂਦੀ ਨਾਂ ਕੋਈ ਐਕਸਸਾਈਜ਼ ਕੁਛ ਵੀ ਨਹੀਂ ਕਰ ਸਕਦਾ ਜੇ ਕੁਛ ਕਰ ਲੈਂਦੇ ਆ ਹਾਂ ਹੱਡ ਬਜ਼ੁਰਗ ਬੰਦਾ ਜੋ ਉਹਨੂੰ ਕੋਈ ਨਾ ਕੋਈ ਦਿੱਕਤ ਆ ਜਾਂਦੀ ਜਿਸ ਕਰਕੇ ਬਜ਼ੁਰਗ ਨੂੰ ਬਹੁਤ ਦਿੱਕਤ ਹੁੰਦੀ ਆ ਉਸ ਉਮਰ ਦੇ ਵਿੱਚ ਤੇ ਹੋਰ ਵੀ ਜਿਵੇਂ ਟੈਂਸ਼ਨ ਲੈਣੀ ਜਿਸ ਕਰਕੇ ਉਹਨਾਂ ਦਾ ਖਾਣ ਪੀਣਾ ਐ ਜੋ ਉਹ ਸੈੱਟ ਨਹੀਂ ਰਹਿੰਦਾ ਤੇ ਜਿਸ ਕਰਕੇ ਉਹਨਾਂ ਨੂੰ ਦਿੱਕਤ ਆਉਂਦੀ ਹੈ ਅੱਗੇ ਤੋਂ ਅੱਗੇ ਜਾ ਕੇ ਤਾਂ ਬਜ਼ੁਰਗ ਬੰਦੇ ਲਈ ਬਹੁਤ ਔਖਾ ਹੁੰਦਾ ਬਹੁਤ ਮੁਸ਼ਕਿਲਾਂ ਦੇਖਣੀਆਂ ਪੈਂਦੀਆਂ ਕਿਉਂਕਿ ਪਹਿਲਾਂ ਕਿਤੇ ਉ ਉੱਠਣਾ ਬੈਠਣਾ ਭੱਜਣਾ ਦੌੜਨਾ ਸਭ ਕੁਝ ਦੇਖਣਾ ਅਤੇ ਕਿੱਥੇ ਬੁਢਾਪੇ ਵਿੱਚ ਆ ਕੇ ਸਾਰਾ ਕੁਝ ਬੰਦ ਹੋ ਜਾਂਦਾ ਨਿਗ੍ਹਾ ਘੱਟ ਜਾਂਦੀ ਹੈ ਉੱਠਣਾ ਬੈਠਣਾ ਖਾਣਾ ਪੀਣਾ ਢੰਗ ਨਾਲ ਨਹੀਂ ਹੁੰਦਾ ਸਾਰਾ ਕੁਛ ਜੋ ਵੀ ਹੁੰਦਾ ਆਪਣਾ